ਮੈਨੂੰ ਮਾਂ ਖੇਡ ਕਬੱਡੀ ਬਹੁਤ ਪਸੰਦ ਹੈ ਇਹ ਗੇਮ ਇੱਕ ਅਲੱਗ ਗੇਮ ਹੈ ਜਿਸ ਵਿੱਚ ਸਰੀਰਕ ਅਤੇ ਮਾਨਸਿਕ ਤੌਰ 'ਤੇ ਬੰਦੇ ਦੀ ਹਰ ਟਾਈਮ ਵਰਜਿਸ਼ ਹੁੰਦੀ ਰਹਿੰਦੀ ਹੈ ਕਸਰਤ ਹੁੰਦੀ ਰਹਿੰਦੀ ਹੈ ਇਹ ਗੇਮ ਸਾਡੇ ਪੰਜਾਬ ਦੀ ਇੱਕ ਸਿਰਲ ਸਿਰਲੱਥ ਗੇਮ ਹੈ ਜੋ ਕਿ ਹਰੇਕ ਪੰਜਾਬੀ ਦੇ ਮਨ ਵਿੱਚ ਵੱਸਦੀ ਹੈ ਇਸ ਗੇਮ ਨਾਲ਼ ਮੈਨੂੰ ਬਹੁਤ ਪਿਆਰ ਹੈ ਮੈਂ ਇਸ ਨੂੰ ਹਰ ਟਾਈਮ ਖੇਡਣਾ ਚਾਹੁੰਦਾ ਹਾਂ ਅਤੇ ਇਸ ਨੂੰ ਖੇਡਦਾ ਹਾਂ ਕਬੱਡੀ ਇੱਕ ਅਜਿਹੀ ਗੇਮ ਹੈ ਜਿਸ ਨਾਲ਼ ਬੰਦੇ ਨੂੰ ਪ ਨਸ਼ਿਆਂ ਤੋਂ ਵੀ ਬਚਾਇਆ ਜਾ ਸਕਦਾ ਹੈ ਇਸ ਵਿੱਚ ਇਹ ਇੱਕ ਸੱਭਿਆਚਾਰਕ ਵੀ ਸੱਭਿਆਚਾਰ ਵੀ ਕਰਦੀ ਹੈ ਜੋ ਕਿ ਹਰੇਕ ਬੰਦੇ ਨੂੰ ਇਸ ਨੂੰ ਦੇਖ ਕੇ ਆਨੰਦ ਆਉਂਦਾ ਹੈ ਕਬੱਡੀ ਇੱਕ ਪੰਜਾਬ ਦੀ ਮਾਂ ਖੇਡ ਕਬੱਡੀ ਹੈ ਜੋ ਕਿ ਹਰ ਪੰਜਾਬੀ ਦੇ ਦਿਲ ਵਿੱਚ ਧੜਕਦੀ ਹੈ ਕਬੱਡੀ ਨੂੰ ਹਰੇਕ ਇੱਕ ਖੇਡਣਾ ਚਾਹੁੰਦਾ ਹੈ ਪੰਜਾਬ ਵਿੱਚ ਇਹ ਹਰੇਕ ਪਿੰਡ ਵਿੱਚ ਇੱਕ ਇੱਕ ਟੂਰਨਾਮੈਂਟ ਹੁੰਦਾ ਹੈ ਜਿਸ ਨੂੰ ਮੈਂ ਦੇਖਣ ਜਾਂਦਾ ਹਾਂ ਉੱਥੇ ਬਹੁਤ ਮਨ ਲੱਗਦਾ ਹੈ ਦੇਖ ਕੇ ਕਬੱਡੀ ਟੂਰਨਾਮੈਂਟ ਜੋ ਕਿ ਹਰ ਪੰਜਾਬ ਵਿੱਚ ਹਰੇਕ ਪਿੰਡ ਵਿੱਚ ਹੁੰਦੇ ਰਹਿੰਦੇ ਹਨ